ਪੰਜਾਬ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਤਾਂ ਉਪਲਬਧ ਹੈ ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਮੂਵੀ ਥੀਏਟਰ ਹਨ ਛੋਟੇ ਵੀ ਅਤੇ ਵੱਡੇ ਵੀ ਜਿਵੇਂ ਕਿ ਛੋਟਿਆਂ ਸ਼ਹਿਰਾਂ ਵਿੱਚ ਬਠਿੰਡਾ ਵਿੱਚ ਵੀ ਜਿਵੇਂ ਮਿੱਤਲ ਮੋਲ ਵਿੱਚ ਇੱਕ ਥੀਏਟਰ ਅਵੇਲੇਬਲ ਹਨ ਜਿੱਥੇ ਟਿਕਟ ਦਾ ਪ੍ਰਾਈਸ ਬਹੁਤ ਘੱਟ ਹੁੰਦਾ ਹੈ ਜਿਵੇਂ ਜਿਵੇਂ ਅਸੀਂ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਵੱਲ ਜਾਂਦੇ ਹਾਂ ਉੱਥੇ ਬਹੁਤ ਹੀ ਜ਼ਿਆਦਾ ਵੱਡੇ ਥੀਏਟਰ ਹੋ ਜਾਂਦੇ ਅਤੇ ਉਹਨਾਂ ਦੀ ਜਿਹੜਾ ਟਿਕਟ ਦਾ ਪ੍ਰਾਈਸ ਆ ਫੋਰ ਹੰਡਰਡ ਫਾਈਵ ਹੰਡਰਟ ਤੱਕ ਚਲਾ ਜਾਂਦਾ ਕਿਉਂਕਿ ਉੱਥੇ ਫੈਸਿਲਿਟੀ ਸੋਫਾ ਦੀ ਫੈਸਿਲਿਟੀ ਹੋ ਜਾਂਦੀ ਹੈ ਅਤੇ ਜਿਵੇਂ ਜਿਵੇਂ ਆਪਾਂ ਥੀਏਟਰ 'ਚ ਐਂਟਰ ਕਰਦੇ ਹਾਂ ਉੱਥੋਂ ਦੇ ਵਾਟਰ ਦਾ ਪ੍ਰਾਈਸ ਅਤੇ ਉਥੋਂ ਦੇ ਖਾਣ ਪੀਣ ਪੋਪਕੋਨ ਹਰ ਇੱਕ ਚੀਜ਼ ਦਾ ਪ੍ਰਾਈਸ ਵਧ ਜਾਂਦਾ ਹੈ ਐਸ ਕੰਪੇਅਰ ਟੂ ਦਾ ਛੋਟੇ ਸ਼ਹਿਰਾਂ ਨਾਲੋਂ ਅਤੇ ਜਿਵੇਂ ਅਸੀਂ ਬੈਠਣਾ ਅੱਗੇ ਬੈਠਣਾ ਅਤੇ ਸਾਡੀ ਜਿਹੜਾ ਟਿਕਟ ਦਾ ਪ੍ਰਾਈਸ ਉਹ ਜ਼ਿਆਦਾ ਹੋਏਗਾ ਜਿਵੇਂ ਜਿਵੇਂ ਅਸੀਂ ਪਿੱਛੇ ਬੈਠਣਾ ਤਾਂ ਉਸ ਤੋਂ ਉਹਦਾ ਜਿਹੜਾ ਪ੍ਰਾਈਜ ਆ ਉਹ ਘੱਟ ਹੁੰਦਾ ਜਾਏਗਾ ਸਾਰੀਆਂ ਸਹੂਲਤਾਂ ਉਪਲਬਧ ਹਨ ਉੱਥੇ